ਹੈਲੋ ਸਤਿ ਸ਼੍ਰੀ ਅਕਾਲ ਮੈਡਮ ਜੀ ਮੈਡਮ ਮੈਂ ਨਾ ਵੈਡਿੰਗ ਪਲਾਨਰ ਬੋਲ ਰਹੀ ਹਾਂ ਮੈਂ ਸੁਣਿਆ ਤੁਹਾਡਾ ਕੰਮ ਫਲੋਰਸ ਦਾ ਹੈਗਾ ਇੱਕ ਨਾ ਵਿਆਹ ਆ ਰਿਹਾ ਸੀ ਅਗਲੇ ਮਹੀਨੇ ਅਗਲੇ ਮਹੀਨੇ ਪੰਦਰਾਂ ਸੋਲਾਂ ਅਤੇ ਸਤਾਰਾਂ ਤਾਰੀਖ਼ ਤੁਸੀਂ ਫਰੀ ਹੋ ਸਾਨੂੰ ਨੈਚੁਰਲ ਫਲਾਸ ਦੀ ਡੈਕੋਰੇਸ਼ਨ ਚਾਹੀਦੀ ਹੈ

ਸਾਡਾ ਬਜਟ ਛੇ ਸੱਤ ਲੱਖ 'ਚ ਹੋ ਸਕਦਾ ਹਾਂਜੀ ਮੈਂ ਸੁਣਿਆ ਤੁਹਾਡਾ ਕੰਮ ਬਹੁਤ ਵਧੀਆ ਅਸੀਂ ਬਹੁਤ ਉਮੀਦ ਲੈ ਕੇ ਤੁਹਾਨੂੰ ਫੋਨ ਕੀਤਾ ਹਾਂਜੀ ਅਸੀਂ ਨਾ ਵੈਡਿੰਗ ਦਾ ਥੀਮ ਸੋਚ ਰਹੇ ਸੀਗੇ ਵਾਈਟ ਅਤੇ ਯੈਲੋ ਹਾਂਜੀ ਜੀ ਚਿੱਟੇ ਗੁਲਾਬ ਰੱਖ ਲਈਏ ਅਤੇ ਪੀਲੇ ਅਸੀਂ ਗੇਂਦੇ ਵੀ ਦੇ ਰੱਖ ਲਈਏ ਠੀਕ ਲੱਗੇਗਾ ਪੀਲੇ ਗੇਂਦੇ ਦੇ ਫੁੱਲ ਅੱਛਾ ਜੀ ਠੀਕ ਹੈ ਤੁਸੀਂ ਸਾਨੂੰ ਥੋੜ੍ਹੇ ਆਈਡੀਆ ਵਗੈਰਾ ਕੁਝ ਫੋਟੋ ਇੱਦਾਂ ਦਾ ਕੁਝ ਭੇਜ ਸਕਦੇ ਹੋ ਅੱਛਾ

ਠੀਕ ਹੈ ਠੀਕ ਹੈ ਅਸੀਂ ਫਿਰ ਇੱਕ ਦਿਨ ਮਿਲ ਕੇ ਗੱਲ ਕਰ ਲੈਂਦੇ ਆ ਇਸ ਬਾਰੇ ਠੀਕ ਹੈ ਮੈਂ ਨਾ ਇੱਕ ਵਾਰੀ ਕਲਾਇੰਟ ਨਾਲ ਕਨਫਰਮ ਕਰਕੇ ਤੁਹਾਡਾ ਨਾਮ ਵੀ ਦੱਸਦਾ ਕਿਉਂਕਿ ਕਲਾਇੰਟ ਤੁਹਾਡਾ ਨਾਮ ਸੁਣ ਕੇ ਕਾਫੀ ਖੁਸ਼ ਸੀਗਾ ਅਤੇ ਅਸੀਂ ਤੁਹਾਡੇ ਨਾਲ ਹੀ ਡੀਲ ਡਨ ਕਰ ਲਾਂਗੇ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਡਨ ਹਾਂਜੀ ਠੀਕ ਹੈ ਧੰਨਵਾਦ ਜੀ ਧੰਨਵਾਦ